ਹੈਲੋ ਭਰਾਵਾਂ ਦੇ ਢਾਬੇ ਤੋਂ ਬੋਲ ਰਹੇ ਹੋ ਹਾਂਜੀ ਜੀ ਅਸੀਂ ਤੁਹਾਨੂੰ ਦਸ ਆਈਸ ਕ੍ਰੀਮ ਡੱਬਿਆਂ ਦਾ ਓਰਡਰ ਕੀਤਾ ਸੀ ਪਰ ਤੁਸੀਂ ਤੁਹਾਡੇ ਵੱਲੋਂ ਗਲਤ ਸਮਾਨ ਭੇਜ ਦਿੱਤਾ ਗਿਆ ਹੈ ਅਸੀਂ ਆਈਸ ਕ੍ਰੀਮ ਦੇ ਓਰਡਰ ਕੀਤਾ ਸੀ ਤੁਸੀਂ ਸਾਨੂੰ ਡੋਸਿਆਂ ਦਾ ਸਮਾਨ ਭੇਜ ਦਿੱਤਾ ਹੈ ਅਸੀਂ ਸਾਰਾ ਖਾਣਾ ਖਾ ਚੁੱਕੇ ਹਾਂ ਸਾਡੇ ਕਿਸੇ ਕੰਮ ਨਹੀਂ ਆ ਰਿਹਾ ਪਲੀਜ਼ ਤੁਸੀਂ ਆਪਣਾ ਬੰਦਾ ਭੇਜ ਕੇ ਸਮਾਨ ਵਾਪਸ ਲੈ ਜਾਉ ਸਾਨੂੰ ਆਈਸ ਕ੍ਰੀਮ ਭੇਜ ਦਿਉ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਸਾਡੇ ਪੈਸੇ ਵਾਪਸ ਕਰ ਦਿਉ ਨਹੀਂ ਤਾਂ ਸਾਡੇ ਕਿਉਂਕਿ ਇਹ ਕਿਸੇ ਕੰਮ ਨਹੀਂ ਆ ਰਿਹਾ ਪਲੀਜ਼ ਜਲਦੀ ਕਰ ਲਉ